ਅਸੀਂ ਪੌਦਿਆਂ ਲਈ ਵੱਖ ਵੱਖ ਮੌਸਮ ਦੇ ਆਧਾਰ 'ਤੇ ਸਾਵਧਾਨੀਆਂ ਵਰਤਦੇ ਹਨ ਜਿਵੇਂ ਕਿ ਚਾਵਲ ਗਰਮੀ ਦੇ ਮੌਸਮ ਵਿੱਚ ਹੀ ਉਗਾਇਆ ਜਾਂਦਾ ਹਨ ਅਤੇ ਉਸਨੂੰ ਸਮੇਂ ਸਮੇਂ ਪਰ ਪਾਣੀ ਅਤੇ ਹੋਰ ਆਦਿ ਚੀਜ਼ਾਂ ਦੀ ਜ਼ਰੂਰਤ ਹੁੰਦੀ ਹਨ ਅਤੇ ਜਿਵੇਂ ਕਣਕ ਨੂੰ ਕਣਕ ਨੂੰ ਸਰਦੀਆਂ ਦੇ ਮੌਸਮ ਵਿੱਚ ਹੀ ਉਗਾਇਆ ਜਾਂਦਾ ਹੈ ਔਰ ਇਸਨੂੰ ਸਮੇਂ ਸਿਰ ਧੁੱਪ ਦੀ ਲੋੜ ਹੁੰਦੀ ਹੈ ਅਤੇ ਜ਼ਿਆਦਾ ਗਰਮੀ ਵਿੱਚ ਕਣਕ ਨਹੀਂ ਉਗਾਈ ਜਾਂਦੀ ਹਨ ਅਤੇ ਮੱਕਾ ਗਰਮੀ ਦੇ ਮੌਸਮ ਵਿੱਚ ਹੀ ਹੁੰਦਾ ਹੈ ਇਸਨੂੰ ਸਰਦੀ ਦੇ ਮੌਸਮ ਵਿੱਚ ਨਹੀਂ ਉਗਾਇਆ ਜਾਂਦਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਪਿਆਜ਼ ਵੀ ਪਿਆਜ਼ ਵੀ ਠੰਡ ਦੇ ਮੌਸਮ ਵਿੱਚ ਹੀ ਉੱਗਦੇ ਹਨ ਇਸਨੂੰ ਵੀ ਧੁੱਪ ਦੀ ਲੋੜ ਹੁੰਦੀ ਹਨ ਅਤੇ ਹੋਰ ਸਾਰੀਆਂ ਬਹੁਤ ਚੀਜ਼ਾਂ ਹਨ ਬਰਸਾਤ ਦੇ ਮੌਸਮ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ ਬੇਲਾਂ ਉਗਾਈਆਂ ਜਾਂਦੀਆ ਹਨ ਜਿਵੇਂ ਕਿ ਘੀਆ ਕੱਦੂ ਆਦਿ ਰਾਮ ਤੋਰੀ ਵਗੈਰਾ ਹੁੰਦੀਆਂ ਹਨ ਇਸਨੂੰ ਬਰਸਾਤ ਦੇ ਮੌਸਮ ਵਿੱਚ ਹੀ ਉਗਾਇਆ ਜਾਂਦਾ ਹੈ ਹੋਰ ਵੀ ਗਰਮੀ ਦੇ ਮੌਸਮ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਹਨ ਜਿਸਨੂੰ ਗਰਮੀ ਦੇ ਮੌਸਮ ਵਿੱਚ ਹੀ ਉਗਾਇਆ ਜਾਂਦਾ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਗਰਮੀ ਦੇ ਮੌਸਮ ਵਿੱਚ ਉਗਾਈਆਂ ਜਾਂਦੀਆਂ ਹਨ ਭਿੰਡੀਆਂ ਵਗੈਰਾ ਆਦਿ ਵੀ ਹੁੰਦੀਆਂ ਹਨ ਬੈਂਗਣ ਆਦਿ ਹੁੰਦੇ ਹੈ ਜਿਸਨੂੰ ਅਸੀਂ ਗਰਮੀ ਦੇ ਮੌਸਮ ਵਿੱਚ ਹੀ ਉਗਾਉਂਦੇ ਹਨ